ਸਾਡੇ ਪਿੰਡਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਅਤੇ ਜੜੀਆਂ ਬੂਟੀਆਂ ਦੇ ਝਾੜ ਹੁੰਦੇ ਹਨ ਇਹਨਾਂ ਵਿੱਚ ਜ਼ਹਿਰੀਲੇ ਜੀਵ ਹੁੰਦੇ ਹਨ ਇਹ ਜੀਵ ਜਾਨਵਰ ਇਨਸਾਨਾਂ ਲਈ ਖਤਰਾ ਹੋ ਸਕਦੇ ਹਨ ਕੁਝ ਜੀਵ ਜੰਤੂ ਜ਼ਹਿਰੀਲੇ ਹੁੰਦੇ ਹਨ ਜਿਵੇਂ ਸੱਪ ਬਿੱਛੂ ਕੀੜੇ ਦਮੂਈ ਆਦਿ ਜੇਕਰ ਸੱਪ ਜਾਂ ਕੋਈ ਹੋਰ ਜ਼ਹਿਰੀਲਾ ਕੀੜਾ ਡੰਗ ਮਾਰ ਜਾਵੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਸਾਡੇ ਪਿੰਡਾਂ ਵਿੱਚ ਪਿੰਡਾਂ ਵਿੱਚ ਸੁਰੱਖਿਅਤ ਰਹਿਣ ਲਈ ਅਸੀਂ ਆਪਣੇ ਘਰਾਂ ਵਿੱਚ ਲੱਸੀ ਦਾ ਛਿੜਕਾਅ ਕਰਦੇ ਹਾਂ ਜੇਕਰ ਡੰਗ ਮਾਰ ਜਾਵੇ ਤਾਂ ਸਭ ਤੋਂ ਪਹਿਲਾਂ ਅਸੀਂ ਡੰਗੀ ਹੋਈ ਜਗ੍ਹਾ ਜਗ੍ਹਾ 'ਤੇ ਘੁੱਟ ਕੇ ਘੁੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਜੋ ਜ਼ਹਿਰ ਖੂਨ ਵਿੱਚ ਫੈਲ ਨਾ ਜਾਵੇ ਜ਼ਖਮ ਉੱਤੇ ਮਨੀ ਮਨੀ ਲਗਾ ਕੇ ਜ਼ਹਿਰ ਕੱਢਿਆ ਜਾਂਦਾ ਹੈ ਜਲਦੀ ਇੱਥੇ ਤੇਲ ਦਾ ਲੇਪ ਲਗਾਇਆ ਜਾਂਦਾ ਹੈ ਕੀੜੇ ਮਕੌੜਿਆਂ ਤੋਂ ਬਚਣ ਲਈ ਸਪਰੇਅ ਦਾ ਛਿੜਕਾਅ ਕੀਤਾ ਜਾਂਦਾ ਹੈ